ਮੈਂ ਭੁਪਿੰਦਰ ਸਿੰਘ ਅੱਜ ਤੁਹਾਡੇ ਨਾਲ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵਿਅਕਤੀ ਲਈ ਤੁਹਾਡੇ ਪਿੰਡ ਵਿੱਚ ਪ੍ਰਸਿੱਧ ਘਰੇਲੂ ਉਪਚਾਰ ਦੱਸਣਾ ਚਾਹੁੰਦਾ ਹਾਂ ਕਈ ਲੋਕ ਜਿਹਨਾਂ ਦਾ ਵਜਨ ਬਹੁਤ ਘੱਟ ਹੈ ਉਹ ਵਜਨ ਵਧਾਉਣ ਲਈ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੁਦਰਤੀ ਸਰੋਤਾਂ ਤੋਂ ਵੀ ਵਜਨ ਵਧਾ ਸਕਦੇ ਹੋ ਅੱਜ ਅਸੀਂ ਤੁਹਾਨੂੰ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਹਨਾਂ ਦੀ ਮਦਦ ਨਾਲ ਤੁਸੀਂ ਆਪਣਾ ਵਜਨ ਵਧਾ ਸਕਦੇ ਹੋ ਅੰਡੇ ਅੰਡੇ ਮਾਸਪੇਸ਼ੀਆਂ ਬਣਾਉਣ ਜਾਂ ਭਾਰ ਵਧਾਉਣ ਦਾ ਵਧੀਆ ਸਰੋਤ ਹਨ ਹਾਲਾਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਪਰ ਇਹਨਾਂ ਦੇ ਜ਼ਿਆਦਾ ਸੇਵਨ ਨਾਲ ਭਾਰ ਵੱਧ ਸਕਦਾ ਹੈ ਇਸ ਲਈ ਤੁਹਾਨੂੰ ਪੀਲੀ ਜਰਦੀ ਦੇ ਨਾਲ ਆਂਡੇ ਨੂੰ ਖਾਣਾ ਹੈ ਤਾਂ ਤੁਹਾਨੂੰ ਫਾਇਦਾ ਮਿਲੇਗਾ ਹੋਲ ਗਰੇਨ ਹੋਲ ਗ੍ਰੇਨ ਬਰੈਡ 'ਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਖਰੋਟ ਦੇ ਮੱਖਣ ਨਾਲ ਰੋਟੀ ਖਾਣ ਨਾਲ ਭਾਰ ਵਧਣ ਵਿੱਚ ਮਦਦ ਮਿਲਦੀ ਹੈ ਸੁੱਕੇ ਮੇਵੇ ਸੁੱਕੇ ਮੇਵਿਆ ਵਿੱਚ ਪ੍ਰੋਕਟੋਸ ਦੀ ਮਾਤਰਾ ਵਧੇਰੀ ਹੁੰਦੀ ਹੈ ਜਿਹਨਾਂ ਫਲਾਂ ਵਿੱਚ ਚੀਨੀ ਹੁੰਦੀ ਹੈ ਉਹ ਕੁਦਰਤੀ ਤੌਰ 'ਤੇ ਮਿੱਠੇ ਹੁੰਦੇ ਹਨ ਅਤੇ ਭੋਜਨ ਦੀ ਕੈਲਰੀ ਵਧਾਉਣ ਵਿੱਚ ਫਾਇਦੇਮੰਦ ਮੰਨੇ ਜਾਂਦੇ ਹਨ ਪਨੀਰ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਭਾਰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ ਪਨੀਰ ਵਿੱਚ ਕੈਲਰੀ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ ਪਨੀਰ ਜਾਂ ਚੀਜ਼ ਵੀ ਪ੍ਰੋਟੀਨ ਦਾ ਭਰਪੂਰ ਸਰੋਤ ਮੰਨੇ ਜਾਂਦੇ ਹਨ ਇਸ ਦੇ ਨਾਲ ਨਾਲ ਜੇਕਰ ਅਸੀਂ ਭਾਰ ਵਧਾਉਣਾ ਹੈ ਤਾਂ ਅਸੀਂ ਆਪਣੇ ਘਰ ਵਿੱਚ ਆਪਣਾ ਭੋਜਨ ਵੀ ਵਧਾ ਸਕਦੇ ਹਨ ਜਿਸ ਦੇ ਵਿੱਚ ਸਾਨੂੰ ਕੁਝ ਘਰੇਲੂ ਚੀਜ਼ਾਂ ਵੀ ਖਾਣੀਆਂ ਜ਼ਰੂਰੀ ਹਨ ਪਿੰਨੀ ਪੰਜਾਬ ਵਿੱਚ ਬਣਾਈ ਜਾਂਦੀ ਜਿਸ ਦੇ ਵਿੱਚ ਦੇਸੀ ਘਿਓ ਬਦਾਮ ਅਖਰੋਟ ਆਦਿ ਦਾ ਉਪਯੋਗ ਹੁੰਦਾ ਹੈ ਕਿ ਸਾਡੇ ਭਾਰ ਵਧਾਉਣ ਵਿੱਚ ਮਦਦਗਾਰ ਹੁੰਦੀ ਹੈ ਲੱਡੂ ਲੱਡੂ ਜੋ ਕਿ ਦੇਸੀ ਘਿਓ ਤੋਂ ਬਣਦੇ ਹਨ ਇਹ ਸਾਡੇ ਭਾਰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ ਦੁੱਧ ਦੁੱਧ ਤੋਂ ਬਣ ਰਹੇ ਬਣੇ ਪਦਾਰਥ ਭਾਵ ਦਹੀਂ ਪਨੀਰ ਦੁੱਧ ਪੀਣਾ ਸਾਡੇ ਭਾਰ ਵਧਾਉਣ ਲਈ ਮਦਦਗਾਰ ਹੁੰਦੇ ਹਨ ਫਰੂਟਾਂ ਦੀ ਜੇਕਰ ਗੱਲ ਕਰੀਏ ਤਾਂ ਉਹ ਫਰੂਟ ਜਿਹੜੇ ਕਿ ਕੁਦਰਤੀ ਤੌਰ 'ਤੇ ਮਿੱਠੇ ਹੁੰਦੇ ਹਨ ਉਹ ਸਾਡੇ ਲਈ ਭਾਰ ਵਧਾਉਣ ਦੀ ਮਦਦ ਕਰ ਸਕਦੇ ਹਨ ਭਾਵ ਕਿ ਅੰਬ ਅ ਲੀਚੀ ਅਤੇ ਵਗੈਰਾ ਵਗੈਰਾ ਬਦਾਮ ਅਖਰੋਟ ਵੀ ਸਾਡੇ ਭਾਰ ਵਧਾਉਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ ਅਤੇ ਘਿਓ ਤੋਂ ਵੀ ਸਾਡਾ ਭਾਰ ਜਿਹੜਾ ਉਹ ਵੱਧ ਸਕਦਾ ਹੈ